ਸਤਿ ਸ਼੍ਰੀ ਅਕਾਲ ਸਰ ਹਾਂਜੀ ਹਾਂਜੀ ਹਾਂਜੀ ਸਰ ਇਹ ਮਤਲਬ ਕਿ ਸਾਡੇ ਪਿੰਡ ਹੀ ਹੈ ਗੁਰਦੁਆਰੇ ਦੇ ਨਾਲ ਹੀ ਮੰਟੂ ਦੀ ਡੇਅਰੀ ਹੈ ਇੱਥੇ ਮਤਲਬ ਕਿ ਅੱਛਾ ਪਨੀਰ ਅੱਛਾ ਦੁੱਧ ਵਗੈਰਾ ਦਹੀਂ ਵਗੈਰਾ ਅੱਛਾ ਮਿਲ ਜਾਂਦਾ ਹਾਂਜੀ ਅਤੇ ਸਰ ਉਨ ਉਹਨਾਂ ਦੇ ਨਾਲ ਹੀ ਇੱਕ ਮਾਨ ਡੇਅਰੀ ਹੈ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਉੱਥੋਂ ਵੀ ਹਰ ਸਾਮਾਨ ਮਿਲ ਜਾਂਦਾ ਦੁੱਧ ਪਨੀਰ ਵਗੈਰਾ ਅੱਛਾ ਮਿਲਦਾ ਅੱਛੀ ਕੰਪਨੀ ਦਾ ਮਿਲਦਾ ਹਾਂਜੀ ਹਾਂਜੀ ਮਤਲਬ ਕਿ ਸਰ ਪਨੀਰ ਤਾਂ ਪਨੀਰ ਤਾਂ ਮਹਿੰਗਾ ਤ ਤਿੰਨ ਸੌ ਰੁਪਇਆ ਕਿਲੋ ਪਨੀਰ ਹੈ ਅਤੇ ਸੱਤਰ ਅੱਸੀ ਰੁਪਏ ਮਤਲਬ ਕਿ ਦਹੀਂ ਜਾ ਰਿਹਾ ਇਸ ਵੇਲੇ ਹਾਂਜੀ ਹਾਂ ਦੁੱਧ ਵੀ ਤਾਂ ਮੈਂ ਮਤਲਬ ਕਿ ਜਾ ਰਿਹਾ ਸੌ ਰੁਪਇਆ ਕੇ ਜੀ ਜਾ ਰਿਹਾ ਦੁ ਦੁੱਧ ਵੀ ਹਾਂਜੀ

ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਫਰੈਸ਼ ਜਿੱਦਾਂ ਵੀ ਤੁਸੀਂ ਚਾਹੋ ਚਾਹੁੰਦੇ ਹੋਓਗੇ ਸਮਾਨ ਲੈਣਾ ਉੱਦਾਂ ਹੀ ਫਰੈਸ਼ ਸਮਾਨ ਇਕਦਮ ਤੁਹਾਨੂੰ ਤਾਜ਼ਾ ਮਿਲੇਗਾ ਦਹੀਂ ਵੀ ਇਕਦਮ ਤਾਜ਼ਾ ਪਨੀਰ ਵੀ ਦੁੱਧ ਵੀ ਇਕਦਮ ਤਾਜ਼ਾ ਮਿਲੇਗਾ ਹਾਂਜੀ ਤੁਸੀਂ ਲੈ ਸਕਦੇ ਹੋ ਕੋਈ ਮਤਲਬ ਕਿ ਇੱਦਾਂ ਦੀ ਗੱਲ ਨਹੀਂ ਹੈ ਅਵੇਲੇਵਲ ਸਾਰਾ ਸਮਾਨ ਮਿਲ ਜਾਂਦਾ ਹਾਂਜੀ ਹਾਂਜੀ ਸਰ ਜੀ ਕੋਈ ਗੱਲ ਨਹੀਂ ਠੀਕ